ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਕੋਲਜ ਹਨ ਅਤੇ ਕਾਫੀ ਯੂਨੀਵਰਸਿਟੀਆਂ ਹਨ ਜਿਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਥਾਪਰ ਯੂਨੀਵਰਸਿਟੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਸ਼ਾਮਿਲ ਹਨ ਇਸ ਤੋਂ ਇਲਾਵਾ ਇਥੇ ਬਹੁਤ ਸਾਰੇ ਮਸ਼ਹੂਰ ਕੋਲਜ ਖਾਲਸਾ ਕੋਲਜ਼ ਮਹਿੰਦਰਾ ਕੋਲਜ਼ ਮੁਲਤਾਨੀ ਮੋਦੀ ਕੋਲਜ਼ ਅਤੇ ਬਹੁਤ ਸਾਰੇ ਬੀਐੱਡ ਕੋਲਜ ਨੇ ਜਿਵੇਂ ਕਿ ਏਸ਼ੀਅਨ ਗਰੁੱਪ ਆਫ ਇੰਸਟੀਚੀਊਟਸ ਅਤੇ ਸਟੇਟ ਕੋਲਜ ਬਹੁਤ ਮਸ਼ਹੂਰ ਹੈ ਜਿੱਥੇ ਬੀਐੱਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਗਰਲਸ ਦੇ ਲਈ ਮਾਤਾ ਸਾਹਿਬ ਕੌਰ ਗਰਲਸ ਕੋਲਜ ਬਹੁਤ ਮਸ਼ਹੂਰ ਹੈ ਕਾਫੀ ਸਾਰੇ ਕੋਲਜ ਨੇ ਜਿਵੇਂ ਲੋਅ ਦਾ ਕੋਲਜ ਹੈ ਕਾਮਰਸ ਕੋਲਜ ਹੈ ਇਥੇ ਬੱਚੇ ਉਚੇਰੀ ਸਿੱਖਿਆ ਦੇ ਲਈ ਦੂਰੋਂ ਦੂਰੋਂ ਆਉਂਦੇ ਹਨ ਮੈਨੂੰ ਲੱਗਦਾ ਪਟਿਆਲਾ ਇੱਕ ਅਜਿਹੀ ਸ ਜਗ੍ਹਾ ਹੈ ਜਿੱਥੇ ਸਿੱਖਿਆ ਦਾ ਇੱਕ ਬਹੁਤ ਵੱਡਾ ਕੇਂਦਰ ਬਣ ਚੁੱਕਿਆ ਹੈ ਲੋਕ ਹੋਰ ਸਟੇਟਾਂ ਤੋਂ ਵੀ ਇੱਥੇ ਪੜ੍ਹਨ ਲਈ ਆਉਂਦੇ ਹਨ ਇੱਥੇ ਕਿਉਂਕਿ ਉਚੇਰੀ ਸਿੱਖਿਆ ਦੇ ਲਈ ਬਹੁਤ ਸਾਰੀਆਂ ਓ ਓਪਰਚੁਨੀਟੀਆਂ ਦਿੱਤੀਆਂ ਜਾਂਦੀਆਂ ਹਨ ਮੇਰੇ ਦੋ ਭਰਾ ਪੜ੍ਹ ਰਹੇ ਨੇ ਮੋਦੀ ਕੋਲਜ ਦੇ ਵਿੱਚ ਉਹਨਾਂ ਦੀ ਗ੍ਰੈਜੂਏਸ਼ਨ ਪੂਰੀ ਹੋਣ ਵਾਲੀ ਹੈ ਅਤੇ ਉਹ ਇੱਥੋਂ ਬਹੁਤ ਵਧੀਆ ਸਿੱਖਿਆ ਲੈ ਰਹੇ ਨੇ ਨਾਲ ਨਾਲ ਉਹ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਕੋਲਜ ਦੇ ਵਿੱਚ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਜ਼ਿੰਦਗੀ 'ਚ ਵਧਣ ਦੇ ਲਈ ਪੇਪਰਾਂ ਦੀਆਂ ਤਿਆਰੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਇੱਕ ਵਧੀਆ ਨੌਕਰੀ ਲੈ ਸਕਣ ਮੈਨੂੰ ਲਗਦਾ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਜਾਂ ਹਰੇਕ ਸ਼ਹਿਰ ਦੇ ਵਿੱਚ ਅਜਿਹੀਆਂ ਸੰਸਥਾਵਾਂ ਹੋਣੀਆਂ ਜ਼ਰੂਰੀ ਹੁੰਦੀਆਂ ਹਨ ਤਾਂ ਕਿ ਉੱਥੋਂ ਦੇ ਵਿਦਿਆਰਥੀ ਨੇ ਉਚੇਰੀ ਸਿੱਖਿਆ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਕਰ ਸਕਣ ਅਤੇ ਉਹਨਾਂ ਨੂੰ ਕੀਤੇ ਬਹੁਤ ਦੂਰ ਦੁਰਾਡੇ ਨਾ ਜਾਣਾ ਪਵੇ ਉਹ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਹੀ ਆਪਣੀ ਸ਼ਕਸ਼ੀਅਤ ਨੂੰ ਇੱਕ ਵਧੀਆ ਤਰੀਕੇ ਨਾਲ ਨਿਖਾਰ ਸਕਣ ਅਤੇ ਉਹਨਾਂ ਨੂੰ ਇਹੋ ਜੇ ਮੌਕੇ ਪ੍ਰਦਾਨ ਹੁੰਦੇ ਹੀ ਰਹਿਣ ਤਾਂ ਕਿ ਉਹ ਆਪਣੇ ਮਾਪਿਆਂ ਦਾ ਆਪਣੇ ਸਮਾਜ ਦਾ ਨਾਮ ਰੌਸ਼ਨ ਕਰ ਸਕਣ ਉਚੇਰੀ ਵਿੱਦਿਆ ਦੇ ਮਾਮਲੇ 'ਚ ਆਪਾਂ ਕਹਿ ਸਕਾਂਗੇ ਕਿ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਕੋਲਜ ਅਤੇ ਯੂਨੀਵਰਸਿਟੀਆਂ ਹਨ ਜਿੱਥੋਂ ਬਹੁਤ ਸਾਰੇ ਲੋਕਾਂ ਨੇ ਵਿੱਦਿਆ ਪ੍ਰਾਪਤ ਕਰਕੇ ਆਪਣੇ ਜੀਵਨ ਸ਼ੈਲੀ ਨੂੰ ਇੱਕ ਵਧੀਆ ਮੁਕਾਮ 'ਤੇ ਪਹੁੰਚਾਇਆ ਹੈ